ਇੱਕ ਹਾਲੀਆ ਡਰਾਇੰਗ ਲਈ ਮੈਂ ਇੱਕ ਭੀੜ ਭੜੱਕੇ ਵਾਲੇ ਸ਼ਹਿਰ ਦੇ ਬਜ਼ਾਰ ਦੀ ਹਫੜਾ ਤਫੜੀ ਵਾਲੀ ਊਰਜਾ ਨੂੰ ਕੈਪਚਰ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਇੱਕ ਜੀਵੰਤ ਪਾਚੋਖੜ ਬਣਾਉਣ ਲਈ ਵਾਟਰ ਕਲਰ ਵੋਸ਼ ਦੇ ਸੁਮੇਲ ਦੀ ਵਰਤੋਂ ਕੀਤੀ ਫਿਰ ਸਟੋਲ 'ਤੇ ਖੜ੍ਹੇ ਹੋਏ ਲੋਕਾਂ ਨੂੰ ਬਣਾਉਣ ਲਈ ਬਰੀਕ ਟਿੱਪ ਵਾਲੇ ਪੈ ਸਿਆਹੀ ਪੈਨ ਨਾਲ ਉਹਨਾਂ ਨੂੰ ਬਣਾਇਆ ਅਤੇ ਵਿੱਚ ਮੈਂ ਬਜ਼ਾਰ ਦੇ ਆਲੇ ਦੁਆਲੇ ਖੜ੍ਹੇ ਹੋਏ ਫਲਾਇਰਾਂ ਅਤੇ ਪੋਸਟਰਾਂ ਨੂੰ ਦਰਸਾਉਣ ਲਈ ਫਟੇ ਹੋਏ ਅਖ਼ਬਾਰ ਦੇ ਟੁਕੜੇ ਲ ਲਗਾਏ ਜਿਸ ਦੇ ਬਣਤਰ ਅਤੇ ਯਧਾਰਤਵਾਦ ਦੀ ਇੱਕ ਪਰਤ ਜੋੜੀ ਜਿਸ ਨਾਲ ਦ੍ਰਿਸ਼ਯ ਨੂੰ ਵਧੇਰੇ ਗਤੀਸ਼ੀਲ ਅਤੇ ਜੀਵੰਤ ਮਹਿਸੂਸ ਹੋਇਆ ਇਹਨਾਂ ਵੱਖ ਵੱਖ ਮੀਡੀਅਮਾਂ ਨੂੰ ਮਿਲਾ ਕੇ ਮੈਂ ਸਮੁੱਚੇ ਮਾਹੌਲ ਅਤੇ ਪੜੀ ਭੜੱਕੇ ਵਾਲੇ ਬਜ਼ਾਰ ਦੇ ਖਾਸ ਵ ਵਿਧਵਿਆਂ ਦੋਵਾਂ ਨੂੰ ਵਧੇਰੇ ਦਿਲਚਸਪ ਤਰੀਕੇ ਨਾਲ ਵਿਅਕਤ ਕਰਨ ਦੇ ਯੋਗ ਸੀ ਜੇਕਰ ਮੈਂ ਸਿਰਫ ਇੱਕ ਮੀਡੀਅਮ ਦੀ ਵਰਤੋਂ ਕੀਤੀ ਹੁੰਦੀ